ਸਤਿ ਸ਼੍ਰੀ ਅਕਾਲ ਜੀ ਕੀ ਤੁਸੀਂ ਸਾਹਿਲ ਹੋਟਲ ਤੋਂ ਬੋਲ ਰਹੇ ਓਂ ਸਾਨੂੰ ਰਹਿਣ ਲਈ ਦੋ ਕਮਰਿਆਂ ਦੀ ਲੋੜ ਸੀ ਤੁਹਾਡੇ ਕੋਲ ਹੋਟਲ ਦੇ ਵਿੱਚ ਦ ਠੀਕ ਹੈ ਸਾਨੂੰ ਕਮਰਾ ਦੋ ਦਿਨ ਲਈ ਚਾਹੀਦਾ ਦੋ ਕਮਰਿਆਂ ਦੀ ਲੋੜ ਹੈ ਅਸੀਂ ਅੱਠ ਪਰਿਵਾਰ ਦੇ ਮੈਂਬਰ ਹਾਂ ਇਕੱਲਾ ਇਕੱਲਾ ਚਾਹੀਦਾ ਜੀ ਤੁਸੀਂ ਦੱਸ ਸਕਦੇ ਹੋ ਸਾਨੂੰ ਕਮਰਿਆਂ ਵਿੱਚ ਕੀ ਕੀ ਸੁਵਿਧਾਵਾਂ ਮਿਲ ਸਕਦੀਆਂ ਹਨ ਮਤਲਬ

ਠੀਕ ਹੈ ਠੀਕ ਹੈ ਕਿੰਨਾਂ ਕਿੰਨਾਂ ਕੁ ਕਿਰਾਇਆ ਆ ਜੇਗਾ ਸਾਨੂੰ ਇਸ ਦੇ ਲਈ ਹਾਂਜੀ ਠੀਕ ਹੈ ਅਤੇ ਸਾਡੀ ਗੱਡੀ ਪ ਨੂੰ ਪਾਰਕ ਕਰਨ ਦੇ ਲਈ ਕੋਈ ਜਗ੍ਹਾ ਹੈਗੀ ਤੁਹਾਡੇ ਹੋਟਲ ਦੇ ਵਿੱਚ ਠੀਕ ਹੈ ਅਤੇ ਪਾਰਕਿੰਗ ਏਰੀਆ ਦੀ ਵੀ ਕੋਈ ਫੀਸ ਵਗੈਰਾ ਹੋਏਗੀ ਠੀਕ ਹੈ ਜੀ ਅਤੇ ਮੈਂ ਤੁਹਾਨੂੰ ਦੋ ਘੰਟੇ ਤੱਕ ਦੱਸਦੀ ਹਾਂ ਕਿ ਅਸੀਂ ਕਮਰਾ ਕ ਲੈਣਾ ਕਿ ਨਹੀਂ ਧੰਨਵਾਦ